ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੱਸੋ ਕੋਈ ਚੱਕਰ ਨਹੀਂ ਹੈ ਜੀ ਮਿਲ ਜੂਗੀ ਜੀ ਦੇਖੋ ਪਰ ਬੰਦਾ ਰੇਟ ਬੈਠੇਗਾ ਹਜ਼ਾਰ ਰੁਪਏ ਜੀ ਤਾਂ ਅੱਠ ਬੰਦਿਆਂ ਦਾ ਲਾ ਲਓ ਜੀ ਹੋ ਗਿਆ ਅੱਠ ਹਜ਼ਾਰ ਹਾਂਜੀ ਹਾਂਜੀ ਆ ਜੂਗੀ ਆ ਜੂਗੀ ਜੀ ਉਹ ਤਾਂ ਕੋਈ ਚੱਕਰ ਨਹੀਂ ਉਹਦੀ ਤੁਸੀਂ ਕੋਈ ਟੈਂਸ਼ਨ ਨਾ ਲਓ ਜੀ ਉਹ ਸਾਡੀ ਜ਼ਿੰਮੇਵਾਰੀ ਹੈ ਨਹੀਂ ਨਹੀਂ ਜੀ ਦੇਖੋ ਜੀ ਸਾਡੀ ਸਾਰੀ ਦੀ ਸਾਰੀ ਰਿਸਪੌਸੀਬਿਲਿਟੀ ਸਾਡੀ ਹੈ ਤੁਸੀਂ ਜਮ੍ਹਾਂ ਹੀ ਚਿੰਤਾ ਨਹੀਂ ਕਰਨੀ ਮਟੀਰੀਅਲ ਏ ਵਨ ਕੁਆਲਿਟੀ ਦਾ ਹੋਏਗਾ ਜੀ ਕੋਈ ਸ਼ਿਕਾਇਤ ਦਾ ਮੌਕਾ ਦੇਣ ਤੁਹ ਮਿਲੇਗਾ ਨਹੀਂ ਤੁਹਾਨੂੰ ਦੇਖੋ ਜੀ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਤਾ ਪਰ ਬੰਦਾ ਹਜ਼ਾਰ ਰੁਪਿਆ ਤਾਂ ਅੱਠ ਬੰਦਿਆਂ ਦਾ ਹੋ ਗਿਆ ਅੱਠ ਹਜ਼ਾਰ ਰੁਪਿਆ ਨਹੀਂ ਨਹੀਂ ਦੇਖੋ ਜੀ ਪੰਜ ਛੇ ਸੌ ਤਾਂ ਨਹੀਂ ਮਿਲੇਗਾ ਜੀ ਮੈਕਸੀਮਮ ਤੋਂ ਮੈਕਸੀਮਮ ਪਰ ਬੰਦਾ ਡੇਢ ਸੌ ਰੁਪਏ ਦਾ ਡਿਸਕਾਊਂਟ ਦੇ ਸਕਦਾ ਜੀ ਦੇਖ ਲਓ ਜੇ ਤੁਹਾਨੂੰ ਫਿੱਟ ਬੈਠਦਾ ਤਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਬਣਾ ਕੇ ਭੇਜ ਦੇਵਾਂਗਾ ਤਿੰਨ ਦਿਨਾਂ ਦੇ ਅੰਦਰ ਅੰਦਰ ਠੀਕ ਹੈ ਜੀ ਠੀਕ ਹੈ ਬਾਏ ਓਕੇ ਬਾਏ ਓਕੇ ਬਾਏ